ਹਾਂਜੀ ਮੇਰੇ ਪਿੰਡ ਖੇਤ ਆ ਖੇਤ ਦੇ ਵਿੱਚ ਝੋਨਾ ਹੋ ਗਿਆ ਕਣਕ ਹੋ ਗਈ ਇੱਦਾਂ ਦੇ ਫਸਲਾਂ ਬੀਜਦੇ ਹਾਂ ਪਰ ਬਾਗ ਬ ਬਾਗ ਨਹੀਂ ਹਨ ਮੇਰੇ ਕੋਲ ਅਤੇ ਪੰਛੀਆਂ ਨੂੰ ਪੰਛੀਆਂ ਨੂੰ ਸੰਭਾਲਣ ਵਾਸਤੇ ਜੋ ਵੀ ਮੇਰੇ ਖੇਤ ਦੇ ਵਿੱਚ ਦਰੱਖਤ ਲੱਗੇ ਹਨ ਉਹਨਾਂ ਉੱਤੇ ਇੱਕ ਬਣੇ ਬਣੇ ਹੋਏ ਦੁਕਾਨਾਂ ਤੋਂ ਆਲ੍ਹਣੇ ਮਿਲਦੇ ਹਨ ਉਹਨਾਂ ਦੇ ਲਈ ਉਹ ਆਲ੍ਹਣੇ ਰੱਖਿਆ ਜਾਂਦਾ ਹੈ ਇੱਕ ਉਹਨਾਂ ਵਾਸਤੇ ਇੱਕ ਪਾਣੀ ਦੇ ਜਿਵੇਂ ਪਹਿਲਾਂ ਕੁੱਜੇ ਭਰ ਕੇ ਰੱਖ ਦਿੰਦੇ ਸੀ ਅਤੇ ਉਸ ਤਰ੍ਹਾਂ ਕੁੱਜੇ ਭਰ ਕੇ ਰੱਖੀ ਦੇ ਖੈਰ ਪਿੰਡਾਂ ਦੇ ਵਿੱਚ ਵੀ ਕਾਫੀ ਜਗ੍ਹਾਵਾਂ ਬਣੀਆਂ ਹੁੰਦੀਆਂ ਜਿੱਥੇ ਪੰਛੀਆਂ ਨੂੰ ਚੋਗਾ ਲੋਕ ਪਾ ਕੇ ਆਉਂਦੇ ਆ ਅਤੇ ਸਾਡੇ ਵਿਹੜੇ ਦੇ ਵਿੱਚ ਵੀ ਵਿਹੜੇ ਵਿੱਚ ਨਹੀਂ ਘਰ ਦੀ ਛੱਤ ਉੱਤੇ ਅਸੀਂ ਪੰ ਪੰਛੀਆਂ ਨੂੰ ਜੋ ਵੀ ਦਾਣਾ ਗਾ ਜਾਂ ਕੁਛ ਵੀ ਰੋਟੀਆਂ ਬਚਦੀਆਂ ਉਹ ਪਾਉਂਦੇ ਹਾਂ ਸੋ ਪੰਛੀਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲਣਾ ਚਾਹੀਦਾ ਖੈਰ ਇਸ ਇਸ ਗੱਲ ਉੱਤੇ ਮੈਂ ਇਹੀ ਕਹੂੰਗਾ ਕਿ ਪੰਛੀ ਇੱਕ ਕੁਦਰਤ ਦੀ ਦੇਣ ਹੈ ਇਸ ਨੂੰ ਸੰਭਾਲਣਾ ਸਾਡਾ ਫਰਜ਼ ਹੈ